ਸਾਡੇ ਖੇਤਰ ਵਿੱਚ ਧਾਰਮਿਕ ਅਭਿਆਸਾਂ ਨਾਲ ਬਹੁਤ ਸਾਰੇ ਛੋਟੇ ਛੇਟੋ ਕਾਰੋਬਾਰ ਜੁੜੇ ਹਨ ਜਿਵੇਂ ਕਿ ਸਾਡੇ ਸਿੱਖੀ ਧਰਮ ਵਿੱਚ ਦਸਤਾਰ ਸਿਖਾਉਣਾ ਇਹ ਛੋਟਾ ਕਾਰੋਬਾਰ ਹੋ ਗਿਆ ਬੱਚਿਆ ਨੂੰ ਦਸਤਾਰ ਦੀ ਸਿਖਲਾਈ ਦਿੱਤੀ ਜਾਂਦੀ ਆ ਦੂਸਰਾ ਕਾਰੋਬਾਰ ਜਿੱਦਾਂ ਕਿ ਸਾਡਾ ਸਿੱਖੀ ਧਰਮ ਆ ਹੈ ਨਾ ਸਾਡੇ ਕਕਾਰ ਵਗੈਰਾ ਹੈ ਨਾ ਉਹ ਮਤਲਬ ਵੇਚੇ ਜਾਂਦੇ ਆ ਹੈਨਾ ਉਹਨਾਂ ਦੀਆਂ ਛੋਟੀਆਂ ਛੋਟੀਆਂ ਦੁਕਾਨਾਂ ਹੋ ਗਈਆਂ ਅਤੇ ਹੈ ਨਾ ਇਨ੍ਹਾਂ ਰੋਜ਼ਾਨਾ ਅਭਿਆਸ ਦੇ ਜੀਵਨ ਵਿੱਚ ਹੈ ਨਾ ਸਾ ਇਹ ਯੋਗਦਾਨ ਹੋ ਗਿਆ ਵੀ ਜਿਹੜੇ ਛੋਟੇ ਕਾਰੋਬਾਰ ਕਰਦੇ ਆ ਲੋਕ ਹੈ ਨਾ ਅਤੇ ਉਹ ਦਸਵੰਧ ਕੱਢਦੇ ਆ ਅਤੇ ਉਹ ਗੁਰਦੁਆਰਾ ਸਾਹਿਬ ਪਾਉਂਦੇ ਆ